ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਦੇ ਬਹੁਤ ਸਾਰੇ ਫਾਇਦੇ ਹਨ ਤੈਰਾਕੀ ਭਾਰ ਘਟਾਉਣ ਵਿਚ ਮਦਦਗਾਰ ਹੈ ਤੈਰਾਕੀ ਦਿੱਲ ਦੀ ਧੜਕਣ ਵਧਾਉਣ ਵਿੱਚ ਮਦਦਗਾਰ ਹੈ ਤੈਰਾਕੀ ਹੌਂਸਲਾ ਵਧਾਉਣ ਵਿੱਚ ਮਦਦਗਾਰ ਹੈ ਤੈਰਾਕੀ ਅਸਥਮਾ ਅਤੇ ਸਾਹ ਸੰਬੰਧੀ ਰੋਗਾਂ ਨੂੰ ਘਟਾ ਕੇ ਨਾ ਮਾਤਰ ਕਰਨ ਵਿੱਚ ਮਦਦਗਾਰ ਹੈ ਤੈਰਾਕੀ ਚੰਗੀ ਨੀਂਦ ਲਿਆਉਣ ਵਿੱਚ ਮਦਦਗਾਰ ਹੈ ਤੈਰਾਕੀ ਮਨੋਰੰਜਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਤੈਰਾਕੀ ਤਣਾਓ ਦੂਰ ਕਰਨ ਵਿੱਚ ਮਦਦਗਾਰ ਹੈ ਤੈਰਾਕੀ ਰਾਹੀਂ ਬੱਚਿਆਂ ਦਾ ਹੌਂਸਲਾ ਵਧਾਉਣ ਵਿੱਚ ਬਹੁਤ ਮਦਦ ਮਿਲਦੀ ਹੈ ਤੈਰਾਕੀ ਰਾਹੀਂ ਅਸੀਂ ਆਪਣਾ ਵਿਹਲਾ ਸਮਾਂ ਇਕ ਯੋਗ ਢੰਗ ਨਾਲ ਪ੍ਰਯੋਗ ਕਰ ਸਕਦੇ ਹਾਂ ਤੈਰਾਕੀ ਵਿੱਚ ਸਾਹ ਨਿਯੰਰਤਨ ਨਿਯੰਤਰਣ ਕਰਨ ਸਮੇਂ ਅਸੀਂ ਮੂੰਹ ਰਾਹੀਂ ਸਾਹ ਅੰਦਰ ਅਤੇ ਬਾਹਰ ਕਰਨ ਕਰਦੇ ਹਾਂ ਜਿਸ ਨਾਲ ਫੇਫੜਿਆਂ ਦੀ ਸ਼ਕਤੀ ਵੱਧਦੀ ਹੈ ਅਤੇ ਮਨੁੱਖ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਮਹਿਸੂਸ ਕਰਦਾ ਹੈ